ਮੈਂ ਪੌਦਿਆਂ ਨੂੰ ਬਹੁਤ ਪਸੰਦ ਕਰਦਾ ਹਾਂ ਮੈਨੂੰ ਪੌਦਿਆਂ ਨੂੰ ਉਗਾਉਣਾ ਬਹੁਤ ਚੰਗਾ ਲੱਗਦਾ ਹੈ ਮੈਂ ਘਰ ਵਿੱਚ ਕੁਝ ਫੁੱਲਾਂ ਅਤੇ ਸਬਜ਼ੀਆਂ ਉਗਾਉਂਦਾ ਹਾਂ ਮੈਂ ਘਰ ਵਿੱਚ ਗੁਲਾਬ ਦਾ ਫੁੱਲ ਗੇਂਦੇ ਦਾ ਫੁੱਲ ਅਤੇ ਜੈਸਮੀਨ ਦਾ ਫੁੱਲ ਉਗਾਉਂਦਾ ਹਾਂ ਅਤੇ ਸਬਜ਼ੀਆਂ ਵਿੱਚੋਂ ਤੋਰੀਆਂ ਨਿੰਬੂ ਪਿਆਜ ਮਟਰ ਟਮਾਟਰ ਅਤੇ ਹਰੀਆਂ ਮਿਰਚਾਂ ਘਰ ਵਿੱਚ ਹੀ ਉਗਾਉਂਦਾ ਹਾਂ ਮੈਂ ਪੌਦਿਆਂ ਨੂੰ ਉਗਾਉਣ ਵਿੱਚ ਬਹੁਤ ਸ਼ਾਂਤੀ ਮਹਿਸੂਸ ਕਰਦਾ ਹਾਂ ਮੈਨੂੰ ਪੌਦਿਆਂ ਨਾਲ ਬਹੁਤ ਪਿਆਰ ਹੈ